ਅਸੀਂ ਬਠਿੰਡਾ ਵਿੱਚ ਘੁੰਮਦੇ ਹੀ ਰਹਿੰਦੇ ਹਾਂ ਜਿੱਥੇ ਕਿ ਸ਼੍ਰੀ ਕਿਲ੍ਹਾ ਸਾਹਿਬ ਜ਼ਿਆਦਾ ਹੀ ਮਹੱਤਵਪੂਰਨ ਥਾਂ ਹੈ ਘੁੰਮਣ ਦੇ ਲਈ ਉੱਥੇ ਕਿ ਦੋ ਗੁਰਦੁਆਰੇ ਬਣੇ ਹੋਏ ਹਨ ਲੋਕ ਜਿੱਥੇ ਬਹੁਤ ਸ਼ਰਧਾ ਨਾਲ ਆਉਂਦੇ ਜਾਂਦੇ ਹਨ ਕਿਲ੍ਹੇ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਹੀ ਪਈਆਂ ਹੋਈਆਂ ਹਨ ਜਿਵੇਂ ਕਿ ਉੱਥੇ ਤੋਪਾਂ ਅ ਆਦਿ ਹੋਰ ਵੀ ਹਥਿਆਰ ਬਹੁਤ ਸਾਰੇ ਰਾਜਿਆਂ ਦੇ ਜ਼ਮਾਨੇ ਦੇ ਪਏ ਹੋਏ ਹਨ ਜਿੱਥੇ ਕਿ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਦੇਖਣ ਜਾਂਦੇ ਹਨ ਕਿਲ੍ਹਾ ਸਾਹਿਬ ਕੇ ਬਹੁਤ ਅਜਿਹੀ ਮਹੱਤਵਪੂਰਨ ਥਾਂ ਬਣੀ ਹੋਈ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੀ ਭਾਵਨਾ ਹੈ ਲੋਕ ਦੂਰੋਂ ਦੂਰੋਂ ਇੱਥੇ ਮੱਥਾ ਟੇਕਣ ਵੀ ਆਉਂਦੇ ਹਨ ਕਈ ਲੋਕ ਤਾਂ ਇੱਥੇ ਆ ਕੇ ਘੁੰਮਣ ਘੁੰਮਣ ਦੇ ਲਈ ਵੀ ਆਉਂਦੇ ਹਨ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਕਦੇ ਕਦੇ ਅਸੀਂ ਦੇਖਣ ਜਾਂਦੇ ਹਾਂ ਇਹਦੇ ਵਿੱਚ ਇੱਕ ਕੂਆਂ ਵੀ ਬਣਿਆ ਹੋਇਆ ਜਿਹੜਾ ਕਿ ਬਹੁਤ ਡੂੰਘਾ ਆ ਪਹਿਲਾਂ ਤਾਂ ਉਹ ਖਾਲੀ ਹੁੰਦਾ ਸੀ ਉੱਥੇ ਕੀ ਦੇਖਣ ਨੂੰ ਅਸੀਂ ਜਾਂਦੇ ਸੀ ਪਰ ਹੁਣ ਉਹਦੇ ਵਿੱਚ ਇਹਨਾਂ ਨੇ ਜੰਜੀਰਾਂ ਲਗਾ ਦਿੱਤੀਆਂ ਹਨ ਜਿਹੜਾ ਹੁਣ ਭਰਿਆ ਹੋਇਆ ਹੁੰਦਾ ਹੈ ਜਿੱਦਾਂ ਉੱਥੇ ਕਿਸੇ ਨੂੰ ਜਾਣਾ ਨਹੀਂ ਚਾਹੀਦਾ ਤਾਂ ਇਸ ਲਈ ਅਸੀਂ ਕਿਲ੍ਹਾ ਕਿਲ੍ਹਾ ਸਾਹਿਬ ਵੀ ਜਾਂਦੇ ਹਾਂ ਹੋਰ ਵੀ ਇੱਥੇ ਬਹੁਤ ਜ਼ਿਆਦਾ ਜਿਵੇਂ ਕਿ ਜਲ੍ਹਿਆਂ ਵਾਲਾ ਬਾਗ ਆਪਣੇ ਅੰਮ੍ਰਿਤਸਰ ਵਿੱਚ ਬਣਿਆ ਹੋਇਆ ਉਹ ਵੀ ਇੱਕ ਮਹੱਤਵਪੂਰਨ ਜਗ੍ਹਾ ਹੈ ਅਤੇ ਉੱਥੇ ਵੀ ਅਸੀਂ ਬਹੁਤ ਜ਼ਿਆਦਾ ਸ਼ਰਧਾਲੂ ਜਾਂਦੇ ਹਨ ਉੱਥੇ ਕੀ ਹੈ ਬਹੁਤ ਦੇਖਣ ਨੂੰ ਚੀਜ਼ਾਂ ਮਿਲ ਮਿਲਦੀਆਂ ਹਨ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਆਪਣੇ ਹਰਿਮੰਦਰ ਸਾਹਿਬ ਦੇ ਵਿੱਚ ਅਸੀਂ ਜਾਂਦੇ ਹਾਂ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਜਗ੍ਹਾ ਹੈਗੀ ਹੈ ਜਿੱਥੇ ਕਿ ਬਹੁਤ ਸ਼ਰਧਾਲੂ ਆਉਂਦੇ ਹਨ